ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਬੱਡੀ ਕਿ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਪਿੰਡਾਂ ਵਿੱਚ ਅਤੇ ਇਸ ਨੂੰ ਬਹੁਤ ਹੀ ਜਾਨ ਚਾਹੀਦੀ ਹੈ ਖੇਡਣ ਵਾਸਤੇ ਅਤੇ ਲੋਕ ਇਸ ਖੇਡ ਨਾਲ ਆਪਣਾ ਸਟੈਮੀਨਾ ਵੀ ਬਣਾ ਸਕਦੇ ਹਨ ਗੱਲ ਕਰੀ ਜਾਵੇ ਕੁਸ਼ਤੀ ਦੀ ਉਸ ਵਿੱਚ ਵੀ ਜ਼ੋਰ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਅਤੇ ਬਹੁਤ ਹੀ ਹੋਰ ਵੀ ਖੇਡਾਂ ਜਿਵੇਂ ਕਿ ਰਨਿੰਗ ਹੋ ਗਈ ਤਾਂ ਜੋ ਰੱਸਾਕੱਸੀ ਹੋ ਗਈ ਜੋ ਕਿ ਸਾਨੂੰ ਆਪਣੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ ਅਤੇ ਪਿੰਡਾਂ ਵਿੱਚ ਇਹ ਖੇਡਾਂ ਕਈ ਟੂਰਨਾਮੈਂਟ ਵਿੱਚ ਵੀ ਕਰਵਾਈਆਂ ਜਾਂਦੀਆਂ ਹਨ ਅਤੇ ਉਹਨਾਂ ਬੱਚਿਆਂ ਨੂੰ ਭਵਿੱਖ ਵੀ ਬਣਾਇਆ ਜਾ ਸਕਦਾ ਹੈ